ਪਸ਼ੂ ਪਾਲਣ ਨਾਲ ਸਬੰਧਤ ਨਿਯਮ ਅਤੇ ਕਾਨੂੰਨ ਬਣੇ ਹੋਏ ਹਨ ਜਿਵੇਂ ਕਿ ਗਾਂ ਨੂੰ ਮਾਰਨਾ ਅਤੇ ਭਾਰਤ ਵਿੱਚ ਪੂਰਨ ਪਾਬੰਦੀ ਹੈ ਇਸ ਤਰ੍ਹਾਂ

ਜਿਵੇਂ ਕਿ ਕੁੱਤੇ ਦੇ ਵੱਢਣ ਨਾਲ ਉਸ ਦਾ ਜਿਹੜਾ ਖਮਿਆਜਾ ਜਾਂ ਭਰਪਾਈ ਆ ਉਸ ਦੇ ਮਾਲਕ ਦੁਆਰਾ ਕੀਤੀ ਜਾਂਦੀ ਹੈ ਅਤੇ ਸਾਨੂੰ ਇਸ ਤਰ੍ਹਾਂ ਦੀ ਜਾਣਕਾਰੀ ਯੂਟਿਊਬ ਚੈਨਲਾਂ ਨੂੰ ਮੈਂ ਫੋਲੋ ਕਰਦਾ ਗਾ ਮੈਨੂੰ ਉੱਥੋਂ ਮਿਲਦੀ ਹੈ ਇਸ ਨਾਲ ਸਬੰਧਤ ਕੁਛ ਅਖ਼ਬਾਰ ਆਰਟੀਕਲ ਲੇਖ ਕਿਤਾਬਾਂ ਵਗੈਰਾ ਮੈਂ ਪੜ੍ਹਦਾ ਹੀ ਰਹਿੰਦਾ ਗਾ ਜਿਸ ਬਾਰੇ ਸਾਨੂੰ ਜਾਣਕਾਰੀ ਪ੍ਰਾਪਤ ਹੁੰਦੀ ਰਹੇ